ਸਤਿ ਸ਼੍ਰੀ ਅਕਾਲ ਜੀ ਮੈਂ ਭਾਵਿਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਨੂੰ ਪੰਜਾਬ ਵਿੱਚ ਈਕੋ ਸਿਸਟਮ ਟਿਊਰੀਜ਼ਮ ਦੇ ਬਾਰੇ ਦੱਸਾਂਗੀ ਸਾਡੇ ਪੰਜਾਬ ਬਾਕੀ ਸਾਰੇ ਇਲਾਕਿਆਂ ਦੇ ਮੁਕਾਬਲੇ ਬਹੁਤ ਹੀ ਪ੍ਰਾਕਰਤਿਕ ਹੈ ਕਿਉਂਕਿ ਸਾਡੇ ਪੰਜਾਬ ਵਿੱਚ ਨੇਚਰ ਪਾਰਕ ਵੀ ਬਹੁਤ ਹਨ ਅਤੇ ਹਰ ਪ੍ਰਕਾਰ ਦੇ ਰੁੱਖ ਵੀ ਹਨ ਜੋ ਕਿ ਸਾਡੇ ਲਈ ਬਹੁਤ ਹੀ ਲਾਭਦਾਇਕ ਹਨ ਕਿਉਂਕਿ ਇਹਨਾਂ ਤੋਂ ਸਾਨੂੰ ਸ਼ੁੱਧ ਆਕਸੀਜਨ ਮਿਲਦੀ ਹੈ ਜੋ ਕਿ ਸਾਡੇ ਲਈ ਜ਼ਿੰਦਾ ਰਹਿਣ ਲਈ ਬਹੁਤ ਹੀ ਜ਼ਰੂਰੀ ਹੈ ਇੱਥੇ ਜ਼ੂ ਵੀ ਹਨ ਜਿਸ ਵਿੱਚ ਪਸ਼ੂ ਪੰਛੀਆਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਇੱਥੋਂ ਦੇ ਲੋਕ ਵੀ ਪ੍ਰਾਕਰਤਿਕ ਦਾ ਪੂਰਾ ਧਿਆਨ ਰੱਖਦੇ ਹਨ ਇੱਥੋਂ ਦੇ ਲੋਕ ਥ੍ਰੀ ਆਰ ਫਾਰਮੂਲਾ ਵੀ ਅਪਣਾਉਂਦੇ ਹਨ ਜਿਸ ਦਾ ਮਤਲਬ ਰਿਯੂਜ ਰੀਸਾਈਕਲ ਅਤੇ ਰਿਡਿਊਸ ਹੈ ਇਸ ਦੇ ਅੰਦਰ ਅਸੀਂ ਇੱਕ ਵਾਰ ਵਰਤੀ ਚੀਜ਼ ਨੂੰ ਦੁਬਾਰਾ ਵੀ ਵਰਤਦੇ ਹਾਂ ਉਸ ਨੂੰ ਰੀਸਾਈਕਲ ਕਰਦੇ ਹਾਂ ਅਤੇ ਪਲਾਸਟਿਕ ਦੀਆਂ ਚੀਜ਼ਾਂ ਦੇ ਇਸਤੇਮਾਲ ਨੂੰ ਘਟਾਉਂਦੇ ਰੀਡਿਊਸ ਕਰਦੇ ਹਾਂ ਮੈਂ ਵੀ ਹਰ ਸਾਲ ਆਪਣੇ ਜਨਮਦਿਨ 'ਤੇ ਇੱਕ ਰੁੱਖ ਲਗਾਉਂਦੀ ਹਾਂ ਜਿਸ ਨਾਲ ਮੈਂ ਵੀ ਆਪਣੇ ਪ੍ਰਾਕਰਤਿਕ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਪਾਉਂਦੀ ਹਾਂ ਅੰਤ ਮੈਂ ਸਾਰਿਆਂ ਨੂੰ ਇਹ ਸਲਾਹ ਦੇਵਾਂਗੀ ਕਿ ਜ਼ਿਆਦਾ ਨਾ ਸਹੀ ਪਰ ਆਪਣੇ ਜਨਮਦਿਨ 'ਤੇ ਇੱਕ ਰੁੱਖ ਜ਼ਰੂਰ ਲਾਓ ਤਾਂ ਜੋ ਤੁਸੀਂ ਵੀ ਆਪਣੀ ਪ੍ਰਾਕਰਤਿਕ ਨੂੰ ਸੰਭਾਲਣ ਲਈ ਆਪਣਾ ਯੋਗਦਾਨ ਦੇ ਸਕੋ ਧੰਨਵਾਦ